ਮੇਰਾ ਨਾਮ ਵਿਸ਼ਾਲ ਕੁਮਾਰ ਹੈ ਅਤੇ ਮੈਂ ਨਾ ਔਨਲਾਈਨ ਸ਼ੋਪਿੰਗ ਕੀਤੀ ਸੀ ਅਤੇ ਮੈਂ ਇੱਕ ਜੈਕਟ ਮੰਗਵਾਈ ਸੀ ਮੈਂ ਜੈਕਟ ਬਲੈਕ ਕਾਲੇ ਰੰਗ ਦੇ ਮੰਗਵਾਈ ਸੀ ਅਤੇ ਉਹ ਉਹਨਾਂ ਨੇ ਨੀਲੇ ਰੰਗ ਦੀ ਭੇਜ ਦਿੱਤੀ ਅਤੇ ਜਦ ਮੈਂ ਘਰ ਜਾ ਕੇ ਗਿਆ ਤਾਂ ਉਹ ਜੈਕਟ ਜਾ ਕੇ ਖੋਲ੍ਹੀ ਅਤੇ ਉਸ ਦਾ ਕਲਰ ਨੀਲਾ ਸੀ ਅਤੇ ਉਹ ਮੈਨੂੰ ਵਧੀਆ ਨਹੀਂ ਲੱਗੀ ਅਤੇ ਨਸ ਨਾਲੇ ਹੀ ਉਹ ਫਟੀ ਸੀ ਅਤੇ ਜਿਪ ਵੀ ਖ਼ਰਾਬ ਸੀ ਇਸ ਕਰਕੇ ਮੈਂ ਇਹ ਪ੍ਰੋਡੈਕਟ ਵਾਪਸ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਇਹ ਜੈਕਟ ਬਿਲਕੁਲ ਹੀ ਵਧੀਆ ਨਹੀਂ ਲੱਗੀ ਅਤੇ ਮੈਂ ਇਹ ਜਿਪ ਵੀ ਵ ਖ਼ਰਾਬ ਸੀ ਅਤੇ ਇਸ ਇਸ ਦਾ ਕਲਰ ਵੀ ਨੀਲਾ ਸੀ ਅਤੇ ਇਹ ਮੈਨੂੰ ਬਿਲਕੁਲ ਹੀ ਨਹੀਂ ਵਧੀਆ ਲੱਗਿਆ ਅਤੇ ਮੈਂ ਇਹ ਜੈਕਟ ਵਾਪਸ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਇਹ ਜੈਕਟ ਵਾਪਸ ਕਰਕੇ ਤਾਂ ਕਿ ਮੈਂ ਦੁਬਾਰਾ ਔਡਰ ਕਰ ਸਕਾਂ ਅਤੇ ਮੇਰੀ ਪਸੰਦ ਦੀ ਜੈਕਟ ਆ ਸਕੇ ਅਤੇ ਮੈਨੂੰ ਮਿਲ ਸਕੇ ਇਸ ਕਰਕੇ ਮੈਂ ਇਹ ਜੈਕਟ ਵਾਪਸ ਕਰਨਾ ਚਾਹੁੰਦਾ ਹਾਂ